ਉੱਤਰੀ ਭਾਰਤ ਜਾਂ ਦੱਖਣ ਭਾਰਤ ਵਿੱਚੋਂ ਮੈਨੂੰ ਉੱਤਰੀ ਭਾਰਤ ਦਾ ਭੋਜਨ ਬਹੁਤ ਵਧੀਆ ਲੱਗਦਾ ਹੈ ਦੱਖਣ ਭਾਰਤ ਦਾ ਇਹ ਹੈ ਕਿ ਸਾਡੇ ਪੰਜਾਬੀ ਫੈਮਿਲੀ ਹੈ ਪੰਜਾਬ ਤੋਂ ਬਿਲੋਂਗ ਕਰਦੇ ਹਾਂ ਅਤੇ ਇਸ ਵਿੱਚ ਸਾਨੂੰ ਜ਼ਿਆਦਾ ਕੁਛ ਪਸੰਦ ਨਹੀਂ ਹੈ ਦੱਖਣ ਭਾਰਤ ਵਿੱਚੋਂ ਜਿਹਦੇ ਕਿ ਇਡਲੀ ਡੋਸਾ ਸਾਡੇ ਘਰ 'ਚ ਕੋਈ ਪਸੰਦ ਨਹੀਂ ਕਰਦਾ ਹੈ ਉੱਤਰੀ ਭਾਰਤ ਦਾ ਭੋਜਨ ਸਾਨੂੰ ਬਹੁਤ ਪਸੰਦ ਲੱਗਦਾ ਹੈ ਜਿਵੇਂ ਕਿ ਛੋਲੇ ਭਟੂਰੇ ਹੋ ਗਏ ਖੀਰ ਹੋ ਗਈ ਰਾਜਮਾਂਹ ਚਾਵਲ ਹੋ ਗਏ ਛੋਲੇ ਚੌਲ ਹੋ ਗਏ ਜਿਸ ਨੂੰ ਕਿ ਅਸੀਂ ਪੂਰਾ ਪਰਿਵਾਰ ਆਰਾਮ ਨਾਲ ਬਣਾ ਸਕਦੇ ਹਾਂ ਅਤੇ ਸਭ ਰਲ ਮਿਲ ਕੇ ਬਹਿ ਕੇ ਖਾ ਸਕਦੇ ਹਾਂ ਇਸ ਵਿੱਚ ਵਧੀਆ ਤੋਂ ਵਧੀਆ ਚੀਜ਼ਾਂ ਅਸੀਂ ਬਣਾ ਸਕਦੇ ਆਂ ਜੋ ਕਿ ਸਾਨੂੰ ਪੰਜਾਬ 'ਚ ਰਹਿ ਕੇ ਬਣਾਉਣੀਆ ਆਉਂਦੀਆਂ ਹਨ ਜਿੱਦਾਂ ਕਿ ਦੱਖਣ ਭਾਰਤ ਸਾਨੂੰ ਉਸ ਵਿੱਚ ਕੋਈ ਡੋਸਾ ਇਡਲੀ ਬਣਾਉਣਾ ਨਹੀਂ ਆਉਂਦਾ ਹੈ ਉਹ ਦੱਖਣ ਦੇ ਉਹ ਦੱਖਣੀ ਭਾਰਤ ਦੇ ਲੋਕ ਹੀ ਮਤਲਬ ਬਣਾ ਕੇ ਖਾ ਸਕਦੇ ਹਨ ਅਸੀਂ ਉੱਤਰੀ ਭਾਰਤ ਦੇ ਹੀ ਭੋਜਨ ਪਸੰਦ ਕਰਦੇ ਹਾਂ ਜ਼ਿਆਦਾਤਰ ਇੱਕ ਦੂਜੇ ਨਾਲ ਬਹਿ ਕੇ ਖਾ ਪੀ ਕੇ ਗੱਲਬਾਤ ਕਰ ਸਕਦੇ ਹਾਂ ਮਤਲਬ ਬਹੁਤ ਸਾਰੀਆਂ ਵਰਾਇਟੀਆਂ ਹੈ ਜੋ ਕਿ ਸਾਨੂੰ ਖੁਦ ਘਰ ਵਿੱਚ ਬਣਾ ਸਕਦੇ ਹਾਂ ਅਤੇ ਖਾ ਸਕਦੇ ਹਾਂ ਇਸ ਲਈ ਉੱਤਰੀ ਭਾਰ ਉੱਤਰੀ ਭਾਰਤ ਦਾ ਭੋਜਨ ਸਭ ਤੋਂ ਵਧੀਆ ਲੱਗਦਾ ਹੈ